ਵੈਸੇ ਤਾਂ ਮੈਂ ਕਿਸਾਨ ਨਹੀਂ ਆ ਅਤੇ ਨਾ ਹੀ ਕਿਸਾਨ ਦੀ ਬੇਟੀ ਆ ਪਰ ਜਿਹੜੇ ਪੌਦਿਆਂ ਨੂੰ ਉਗਾਉਣ ਦੇ ਕੁਝ ਜ਼ਰੂਰੀ ਤੱਤ ਨੇ ਉਹਨ ਉਹਨਾਂ ਤੋਂ ਮੈਂ ਵਾਕਫ਼ ਹਾਂ ਮਤਲਬ ਜਿਸ ਤਰ੍ਹਾਂ ਸਾਡੇ ਘਰ ਨਿੰਬੂ ਦਾ ਪੌਦਾ ਹੈਗਾ ਅੰਗੂਰਾਂ ਦਾ ਪੌਦਾ ਹੈ ਤੇ ਐਲੋਵੇਰਾ ਵੀ ਅਸੀਂ ਉਗਾਏ ਹੈਗੇ ਅਤੇ ਟਮਾਟਰ ਵੀ ਟਮਾਟਰ ਤਾਂ ਹੁਣ ਅਸੀਂ ਨਵਾਂ ਜਿਹੜਾ ਪੌਦਾ ਹੈ ਬਹੁਤ ਮਿਹਨਤ ਨਾਲ ਉਗਾ ਰਹੇ ਹਾਂ ਮੇਰੇ ਵੱਡੇ ਜਿਹੜੇ ਭੈਣ ਜੀ ਹੈ ਉਹਨਾਂ ਨੂੰ ਇਹ ਸਭ ਚੀਜ਼ਾਂ ਦਾ ਵਧੀਆ ਸ਼ੌਕ ਹੈ ਤਾਂ ਖਾਦ ਵੀ ਵਰਤਦੇ ਹਾਂ ਅਸੀਂ ਸਪੈਸ਼ਲ ਖਾਦ ਲੈ ਕੇ ਆਉਂਦੇ ਹਾਂ ਅਤੇ ਇੱਕ ਵਾਰ ਅਸੀਂ ਇਹਨਾਂ ਵਿੱਚ ਜਿਹੜਾ ਕਾਓ ਵੇਸਟ ਹੁੰਦਾ ਉਹ ਵੀ ਪਾਇਆ ਸੀਗਾ ਜਿਹਨੂੰ ਗੋਬਰ ਕਹਿੰਦੇ ਹਾਂ ਆਪਾਂ ਉਹਦੇ 'ਚ ਬਹੁਤ ਜ਼ਿਆਦਾ ਵੀ ਉਹ ਉਪਜਾਊ ਹੁੰਦਾ ਮਤਲਬ ਪੌਦਿਆਂ ਲਈ ਬਹੁਤ ਜ਼ਿਆਦਾ ਉਪਜਾਊ ਹੁੰਦਾ ਉਹ

ਨਿੰਬੂ ਦਾ ਪੌਦਾ ਉਹਨੂੰ ਬਹੁਤ ਜ਼ਿਆਦਾ ਸੰਭਾਲ ਦੀ ਲੋੜ ਨਹੀਂ ਹੈ ਉਸਨੂੰ ਸੰਭਾਲ ਦੀ ਲੋੜ ਨਹੀਂ ਹੈਗੀ ਨਿੰਬੂ ਦੇ ਪੌਦੇ ਨੂੰ ਅਤੇ ਉਹ ਚਾਹੇ ਥੋੜ੍ਹਾ ਬਹੁਤ ਹੀ ਪਾਣੀ ਦੇ ਦਿਉ ਉਹਨੂੰ ਉਹਦੇ 'ਚ ਬਸ ਇੱਕ ਵਾਰੀ ਵਧੀਆ ਖਾਦ ਪਾ ਕੇ ਉਹ ਆਪਣੇ ਆਪ ਤੁਹਾਨੂੰ ਸਾਲ ਦੋ ਸਾਲ ਨਿੰਬੂ ਦੇਗਾ ਅਤੇ ਜਿਹੜਾ ਅੰਗੂਰ ਦਾ ਪੌਦਾ ਹੈਗਾ ਉਹ ਅੰਗੂਰ ਦੇ ਪੌਦੇ ਦੇ ਵਿੱਚ ਵੀ ਮਤਲਬ ਉਹਨੂੰ ਬਹੁਤ ਜ਼ਿਆਦਾ ਸੰਭਾਲ ਦੀ ਲੋੜ ਹੈ ਵਧੀਆ ਖਾਦ ਅਤੇ ਵਧੀਆ ਪ੍ਰਕਾਰ ਦੀ ਮਿੱਟੀ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਫਿਰ ਵੀ ਦਿਨ ਮਤਲਬ ਉਹਨੂੰ ਦੋ ਟਾਈਮ ਪਾਣੀ ਚਾਹੀਦਾ ਹੀ ਚਾਹੀਦੇ ਤਾਂ ਹੀ ਉਹਦੀ ਜਿਹੜੀ ਵੇਲ ਆ ਉਹ ਪੂਰੀ ਵਧੀਆ ਤਰ੍ਹਾਂ ਉੱਗਦੀ ਹੈ ਅਤੇ ਉਸ ਦੇ ਉੱਪਰ ਅੰਗੂਰ ਆਉਂਦੇ ਨੇ ਅਤੇ ਜਿਹੜਾ ਐਲੋਵੇਰਾ ਹੁੰਦੇ ਹੈ ਉਹ ਉਹਨਾਂ ਲਈ ਵੀ ਜ਼ਿਆਦਾ ਮਿਹਨਤ ਨਹੀਂ ਲੱਗਦੀ ਉਹ ਆਪਣੇ ਆਪ ਹੀ ਉੱਗਦੇ ਆ ਮਤਲਬ ਇੱਕ ਵਾਰੀ ਆਪਾਂ ਅਗਰ ਉਹਨਾਂ ਨੂੰ ਵਧੀਆ ਖਾਦ ਦੇ ਦੇਈਏ ਵਧੀਆ ਮਿੱਟੀ ਵਧੀਆ ਪ੍ਰਕਾਰ ਦੀ ਮਿੱਟੀ ਤਾਂ ਉਹਨਾਂ ਦੀ ਜਗ੍ਹਾ ਵਧੀਆ ਹੋਵੇ ਤਾਂ ਉਹ ਬਹੁਤ ਵੱਡਾ ਜਿਹੜਾ ਐਲੋਵੇਰਾ ਦਾ ਹੈਗਾ ਉਹ ਉੱਗ ਜਾਂਦੇ ਹੈਗੇ ਐਲੋਵੇਰਾ ਵਿੱਚ ਐਲੋਵੇਰਾ ਅਤੇ ਜਿਹੜਾ ਟਮਾਟਰ ਦਾ ਪੌਦਾ ਹੈਗਾ ਉਹ ਇੱਕ ਤਰ੍ਹਾਂ ਦਾ ਕਲਿੰਬਰ ਹੈ ਉਸਨੂੰ ਸਪੋਰਟ ਚਾਹੀਦੀ ਹੈ ਅਤੇ ਫਿਰ ਉਸ ਲਈ ਮਤਲਬ ਖਾਦ ਦੀ ਵਰਤੋਂ ਵੀ ਚਾਹੀਦੀ ਹੈ ਤਾਂ ਕਿ ਟਮਾਟਰ ਸਾਡੇ ਜਿਹੜੇ ਵਧੀਆ ਉੱਗਣ ਪਾਣੀ ਚਾਹੀਦਾ ਉਹਨੂੰ ਦੋ ਟਾਈਮ ਅਤੇ ਹੋਰ ਫਟੀਲਾਈਜ਼ਰਜ਼ ਚਾਹੀਦੇ ਆ ਅਤੇ ਅਤੇ ਇੱਕ ਹੋਰ ਵੀ ਪਤਾ ਲੱਗਿਆ ਸੀਗਾ ਵੀ ਚਾਵਲਾਂ ਦਾ ਪਾਣੀ ਹੁੰਦਾ ਜਿਹੜਾ ਉਹ ਉਹ ਜਿਹੜਾ ਹੈਗਾ ਆਪਣੇ ਲਈ ਇੱਕ ਤਰ੍ਹਾਂ ਖਾਦ ਦਾ ਕੰਮ ਕਰਦਾ ਵਧੀਆ ਅਤੇ ਉਹਦੇ ਨਾਲ ਉਹ ਜਿਹੜਾ ਮਤਲਬ ਜਿਹੜਾ ਪੌਦੇ ਨੂੰ ਵਧੀਆ ਤੱਤ ਮਿਲਦੇ ਨੇ ਉਹਦੀ ਮਿੱਟੀ ਨੂੰ ਅਤੇ ਉਹ ਵਧੀਆ ਕੰਮ ਕਰਦੇ ਨੇ ਅਤੇ ਹੋਰ ਜਿਹੜੇ ਮਤਲਬ ਆਪਾਂ ਹੋਰ ਪੌਦੇ ਵੀ ਉਗਾਉਂਦੇ ਹਾਂ ਹਰ ਹਰ ਚੀਜ਼ ਹੈ ਜਿਹੜੀ ਇੱਕ ਆਪਣੀ ਕੇਅਰ ਮੰਗਦੀ ਹੈ ਅਤੇ ਧੁੱਪ ਦੀ ਬਹੁਤ ਲੋੜ ਹੈ ਬਾਰਿਸ਼ ਜ਼ਿਆਦਾ ਬਾਰਿਸ਼ ਹੋਜੇ ਤਾਂ ਪੌਦੇ ਖ਼ਰਾਬ ਹੋ ਜਾਂਦੇ ਨੇ ਤਾਂ ਉਹਨੂੰ ਵਧੀਆ ਧੁੱਪ ਚਾਹੀਦੀ ਹੁੰਦੀ ਹੈ ਅਤੇ ਮਤਲਬ ਜਿੱਦਾਂ ਬੀਜ ਹੁੰਦਾ ਨਾ ਬੀਜ ਤੋਂ ਹੀ ਵਧੀਆ ਜਿਹੜਾ ਰੁੱਖ ਹੈ ਉਹ ਉੱਗ ਸਕਦਾ ਹੈ ਨਾ ਅਤੇ ਮਤਲਬ ਇੱਦਾਂ ਹੀ ਕਹਾਂਗੀ ਮੈਂ ਵੀ ਜਿਹੜੀ ਮਤਲਬ ਹਰ ਇੱਕ ਇਨਸਾਨ ਨੂੰ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਪੌਦਾ ਲਗਾਉਣ ਦੇ ਨਾਲ ਵੀ ਐਵੇਂ ਹੁੰਦਾ ਵੀ ਆਪਾਂ ਨੂੰ ਗਰੀਨਰੀ ਸੀਜ਼ਨ ਦਿੰਦੇ ਤਾਂ ਪੌਦੇ ਤਾਂ ਅਮਰੂਦ ਦਾ ਦਰੱਖਤ ਅੰਬ ਦਾ ਦਰੱਖਤ ਇਹ ਸਭ ਬਹੁਤ ਵਧੀਆ ਤਰ੍ਹਾਂ ਉੱਗਦੇ ਨੇ ਇੱਕ ਇਹਨਾਂ ਨੂੰ ਬਸ ਇੱਕ ਵਧੀਆ ਖਾਦ ਵਧੀਆ ਮਿੱਟੀ ਦੀ ਲੋੜ ਹੈ ਜਿੱਦਾਂ ਆਪਣੇ ਸਰੀਰ ਨੂੰ ਸੰਤੁਲਿਤ ਲੈਣ ਲਈ ਸੰਤੁਲਿਤ ਭੋਜਨ ਦੀ ਲੋੜ ਆ ਉਸ ਤਰ੍ਹਾਂ ਹੀ ਪੌਦਿਆਂ ਨੂੰ ਵਧੀਆ ਉੱਗਣ ਲਈ ਸੰਤੁਲਿਤ ਮਿੱਟੀ ਦੀ ਲੋੜ ਹੈ ਅਤੇ ਹਰ ਇੱਕ ਘਰ ਵਿੱਚ ਘੱਟ ਤੋਂ ਘੱਟ ਤਿੰਨ ਚਾਰ ਦਰੱਖਤ ਜ਼ਰੂਰ ਹੋਣੇ ਚਾਹੀਦੇ ਨੇ ਦਰੱਖਤ ਨਹੀਂ ਤਾਂ ਪੌਦੇ ਜ਼ਰੂਰ ਹੋਣੇ ਚਾਹੀਦੇ ਨੇ ਠੀਕ ਹੈ ਜੀ ਅਤੇ ਮੈਨੂੰ ਇਨ੍ਹਾਂ ਹੀ ਪੌਦਿਆਂ ਬਾਰੇ ਜਾਣਕਾਰੀ ਸੀ ਧੰਨਵਾਦ ਜੀ